ਹਾਂ ਮੈਨੂੰ ਹਰਮੋਨੀਅਮ ਸਾਜ਼ ਵਜਾਉਣਾ ਆਉਂਦਾ ਹੈ ਮੈਨੂੰ ਸੰਗੀਤ ਸਿੱਖਣ ਦੀ ਚਾਹਤ ਸ਼ੁਰੂ ਤੋਂ ਹੀ ਸੀ ਪਰ ਮੇਰਾ ਕੋਈ ਸਿੱਖਣ ਦਾ ਜ਼ਰੀਆ ਨਹੀਂ ਸੀ ਬਣ ਰਿਹਾ ਜਦੋਂ ਮੇਰਾ ਸਿੱਖਣ ਦਾ ਜ਼ਰੀਆ ਬਣਿਆ ਉਦੋਂ ਮੈਂ ਅੱਠਵੀਂ ਸ਼੍ਰੇਣੀ ਵਿੱਚ ਸੀ ਅਤੇ ਉਦੋਂ ਹੀ ਮੈਂ ਬੇਬੇ ਨਾਨਕੀ ਅਕੈਡਮੀ ਜਾਣਾ ਸ਼ੁਰੂ ਕਰ ਦਿੱਤਾ ਉੱਥੇ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ ਉੱਥੇ ਮੈਂ ਬਹੁਤ ਸਾਰੇ ਸ਼ਬਦ ਸਿੱਖੇ ਅਤੇ ਮੇਰੇ ਘਰ ਦੇ ਲਾਗੇ ਇੱਕ ਗੁਰਦੁਆਰਾ ਹੈ ਉੱਥੇ ਹਰ ਐਤਵਾਰ ਸ਼ਬਦ ਕੀਰਤਨ ਹੁੰਦਾ ਹੈ ਉੱਥੇ ਸਾਰੇ ਬੱਚੇ ਸ਼ਬਦ ਕੀਰਤਨ ਕਰਦੇ ਹਨ ਅਤੇ ਮੈਂ ਵੀ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਇੱਦਾਂ ਹੀ ਸੰਗੀਤ ਮੇਰਾ ਪੈਸ਼ਨ ਬਣ ਗਿਆ